ਭੰਗੜਾ ਐਕਸਰਸਾਇਜ਼ ਐਰੋਬਿਕਸ ਹੋਰ ਡਾਂਸਾਂ ਦਾ ਰਿਚ ਵਰਕਆਊਟ ਰੂਪਾਂ ਤੋਂ ਵੱਖਰਾ ਹੈ ਇਹ ਸਾਡੀ ਮਾਂ ਬੋਲੀ ਵਿੱਚ ਗੀਤਾਂ 'ਤੇ ਅਧਾਰਿਤ ਹੁੰਦਾ ਹੈ ਇਹ ਗੀਤ ਸੁਣ ਕੇ ਸਾਡਾ ਮਨ ਆਪਣੇ ਆਪ ਨੱਚਣ ਨੂੰ ਕਰਦਾ ਹੈ ਅਤੇ ਇਸ ਦੇ ਨਾਲ ਸਾਡੀ ਐਕਸਰਸਾਇਜ਼ ਹੋ ਜਾਂਦੀ ਹੈ ਬੱਚੇ ਅਤੇ ਬੁੱਢੇ ਵੀ ਇਹਨੂੰ ਕਰਕੇ ਖਾ ਖੁਸ਼ ਹੁੰਦੇ ਹਨ ਭੰਗੜੇ ਵਾਲੇ ਗੀਤ ਸਿੱਧੂ ਮੂਸੇ ਵਾਲਾ ਕਮਲਹੀਰ ਮਨਮੋਨ ਵਾਰਿਸ ਗੁਰਦਾਸ ਮਾਨ ਦੇ ਗੀਤਾਂ ਨੂੰ ਲਾ ਕੇ ਪੈਰ ਆਪਣੇ ਆਪ ਨੱਚਣ ਨੂੰ ਉੱਠ ਜਾਂਦੇ ਹਨ ਹੋਰ ਬਥੇਰੇ ਸਿੰਗਰ ਹਨ ਜਿਨ੍ਹਾਂ ਦੇ ਗਾਣੇ ਲਗਾ ਕੇ ਨੱਚਣ ਨੂੰ ਮਨ ਕਰਦਾ ਹੈ ਇਹ ਸਾਡੇ ਮਨ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ ਅਤੇ ਵਧੀਆ ਵਧੀਆ ਐਕਸਰਸਾਇਜ਼ ਵੀ ਹੋ ਜਾਂਦੀ ਹੈ ਅਤੇ ਮਨ ਨੂੰ ਸੰਤੁਸ਼ਟ ਹੋ ਜਾਂਦਾ ਹੈ